ਸਾਡੇ ਖੇਤਰ ਵਿੱਚ ਇਹ ਕਾਰੋਬਾਰ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਹਨ ਜਿਸ ਤਰ੍ਹਾਂ ਕਿ ਬੁਟੀਕ ਦਾ ਕੰਮ ਹੈ ਇਹ ਘਰ ਬੈਠ ਕੇ ਹੀ ਹੋ ਜਾਂਦਾ ਹੈ ਅਤੇ ਆਮਦਨ ਵੀ ਹੋ ਜਾਂਦੀ ਹੈ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਹੈ ਲੇਡੀਸ ਵਾਸਤੇ ਇੱਕ ਪਾਰਲਰ ਦਾ ਹੈ ਜੋ ਵੀ ਇਹ ਵੀ ਬਹੁਤ ਵਧੀਆ ਕਾਰੋਬਾਰ ਹੈ ਅਤੇ ਇਸ ਨਾਲ ਸਾਨੂੰ ਆਮਦਨ ਵੀ ਠੀਕ ਹੁੰਦੀ ਹੈ ਅਤੇ ਸਾਡੇ ਵਾਸਤੇ ਮਤਲਬ ਕਿ ਡੇਲੀ ਦਾ ਕਾਰੋਬਾਰ ਹੈ ਅਤੇ ਇਸ ਵਿੱਚ ਮਤਲਬ ਕਿ ਅਸੀਂ ਘਰ ਬੈਠ ਕੇ ਹੀ ਆਪਣਾ ਕਾਰੋਬਾਰ ਕਰ ਸਕਦੇ ਹਾਂ ਅਤੇ ਇਸ ਤਰੀਕੇ ਨਾਲ ਇਹ ਕਾਰੋਬਾਰ ਸਾਨੂੰ ਜ਼ਿਆਦਾ ਵਧੀਆ ਲੱਗਦੇ ਹਨ ਹੋਰ ਵੀ ਮਤਲਬ ਕਿ ਸਾਡੇ ਖੇਤਰ ਵਿੱਚ ਇਸ ਤਰ੍ਹਾਂ ਦੇ ਕਾਫ਼ੀ ਕਾਰੋਬਾਰ ਹਨ ਜਿਹੜੇ ਅਸੀਂ ਇੱਦਾਂ ਹੀ ਘਰ ਬੈਠ ਕੇ ਵੀ ਕਰ ਸਕਦੇ ਹਾਂ ਅਤੇ ਅਸੀਂ ਡੇਲੀ ਵੇਜ ਵੀ ਕਰ ਸਕਦੇ ਹਾਂ ਆਮਦਨ ਵੀ ਸਾਨੂੰ ਠੀਕ ਹੁੰਦੀ ਹੈ ਸਟੀਟੀ ਸਟੀਚਿੰਗ ਵਿੱਚ ਅੱਜ ਕੱਲ੍ਹ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਆ ਰਹੇ ਹਨ ਅਤੇ ਇਹਦੇ ਵਿੱਚ ਕਾਫ਼ੀ ਜਿੱਦਾਂ ਫੈਸ਼ਨ ਸ਼ੋ ਵਾਲੇ ਵੀ ਹੁੰਦੇ ਹਨ ਕੱਪੜੇ ਸਿਲਾਈ ਕਰਨਾ ਅਤੇ ਠੀਕ ਤਰੀਕੇ ਨਾਲ ਸਭ ਕੁਛ ਹੋ ਜਾਂਦਾ ਹੈ